ਹੈਲੋ ਸਨਾਰੀ ਸਨਾਰੀਓ ਤੁਸੀਂ ਆਪਣੇ ਸਾਥੀ ਲਈ ਇੱਕ ਅਚਾਨਕ ਹਫਤੇ ਦੇ ਅੰਤ ਵਿੱਚ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਅਸੀਂ ਯੋਜਨਾ ਦੇ ਹਿੱਸੇ ਵਿੱਚ ਇੱਕ ਥੀਏਟਰ ਪਲੇਅ ਲਈ ਟਿਕਟਾਂ ਬੁੱਕ ਕਰਨਾ ਸ਼ਾਮਿਲ ਹੈ ਐਕਸ਼ਨ ਅਚਾਨਕ ਛੁੱਟੀ ਬਾਰੇ ਆਪਣਾ ਸਾਂਝਾ ਕਰੋ ਤੇ ਉਸ ਥੀਏਟਰ ਪਲੇਅ ਦਾ ਜ਼ਿਕਰ ਕਰੋ ਜਿਸ ਵਿੱਚ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਖੇਡ ਦੀ ਮਿਤੀ ਅਤੇ ਸਮੇਂ ਬਾਰੇ ਚਰਚਾ ਕਰੋ ਅਤੇ ਬਿਨਾਂ ਕਿਸੇ ਰਕਾਵਟ ਦੇ ਟਿਕਟਾਂ ਬੁੱਕ ਕਰਨ ਵਿੱਚ ਸਹਾਇਤਾ ਲਈ ਪੁੱਛੋ ਹੈਲੋ ਸਨਾਰੀਓ ਰਾਹੁਲ ਯਾਰ ਮੇਰੇ ਨਾ ਇਸ ਹਫਤੇ ਦੀ ਐਂਡ ਵਿੱਚ ਛੁੱਟੀ ਆ ਰਹੀ ਹੈਗੀ ਅਤੇ ਪਹਿਲਾਂ ਸਾਨੂੰ ਸ ਸੈਚਰਡੇ ਨੂੰ ਬੁਲਾਇਆ ਸੀ ਤਾਂ ਅਚਾਨਕ ਹੁਣ ਪੰਜਾਬ ਸਰਕਾਰ ਵੱਲੋਂ ਛੁੱਟੀ ਕਰ ਦਿੱਤੀ ਗਈ ਹੈਗੀ ਅਤੇ ਸਾਨੂੰ ਛੁੱਟੀ ਨੂੰ ਲੈ ਕੇ ਬਹੁਤ ਭਾਰੀ ਉਤਸ਼ਾਹ ਕੀ ਕਿਉਂਕਿ ਦੋ ਛੁੱਟੀਆਂ ਇਕੱਠੀਆਂ ਹੋਗੀਆਂ ਅਤੇ ਬਾਕੀ ਐਤਵਾਰ ਵੀ ਇਸ ਤਰ੍ਹਾਂ ਕਿ ਆ ਰਿਹਾ ਹੈਗਾ ਅਤੇ ਮੈਨੂੰ ਛੁੱਟੀ ਬਹੁਤ ਖੁਸ਼ੀ ਆ ਗਈ ਅਤੇ ਬਟ ਹੁਣ ਇਸ ਛੁੱਟੀ ਨੂੰ ਅਸੀਂ ਆਪਾਂ ਵਧੀਆ ਇੱਕ ਥੀਏਟਰ ਵਿੱਚ ਪਲੇ ਲੱਗਿਆ ਹੋਇਆ ਹੈਗਾ ਸਾਡੇ ਨਾਮ ਰੋਮੀਓ ਜੂਲਿਟ ਪੈਲਸ ਰੋਮੀਓ ਜੂਲਿਟ ਪੈਲਸ ਸੰਗਰੂਰ 'ਚ ਉੱਥੇ ਇੱਕ ਥੀਏਟਰ ਪਲੇਅ ਚੱਲ ਰਿਹਾ ਹੈਗਾ ਅਤੇ ਮੇਰੀ ਕਾਫੀ ਦਿਨਾਂ ਦੀ ਇੱਛਾ ਸੀ ਮੈਂ ਜਾ ਕੇ ਦੇਖਾ ਥੀਏਟਰ ਪਲੇਅ ਬਹੁਤ ਵਧੀਆ ਹੈਗਾ ਬਟ ਹੁਣ ਛੁੱਟੀ ਨਹੀਂ ਸੀ ਕੋਈ ਮੇਰੇ ਜੀ ਤਾਂ ਅਚਾਨਕ ਹੁਣ ਆਪਾਂ ਨੂੰ ਛੁੱਟੀ ਆ ਗਈ ਸੈਚਰਡੇ ਦੀ ਤਾਂ ਮੇਰਾ ਇਸ ਯੋਜਨਾ ਨੂੰ ਲੈ ਕੇ ਉਤਸ਼ਾਹ ਗਾ ਤੇ ਮੇਰੀ ਸ ਤੇਰੇ ਨਾਲ ਇਹੀ ਸਲਾਹ ਸੀਗੀ ਕਰਨ ਵਾਲੀ ਵੀ ਆਪਾਂ ਉਸ ਥੀਏਟਰ ਮੇਲੇ ਵਿੱਚ ਜਾਣਾ ਗਾ ਅਤੇ ਉੱਥੇ ਜਾ ਕੇ ਆਪਾਂ ਜਿਹੜਾ ਇਹਦਾ ਇੰਜੋਏ ਕਰਨਾ ਗਾ ਅਤੇ ਮੈਨੂੰ ਦੱਸ ਵੀ ਤੂੰ ਟਿਕਟਾਂ ਇਹਦੀਆਂ ਕਿਸ ਤਰ੍ਹਾਂ ਬੁੱਕ ਕਰੇਗਾ ਅਤੇ ਜੇ ਜਾਂ ਤਾਂ ਇਸ ਤਰ੍ਹਾਂ ਕਰੀ ਯਾਰ ਤੂੰ ਨੇੜੇ ਹੈਗਾ ਸ਼ਾਮ ਨੂੰ ਜਾਈ ਸ਼ਾਮ ਨੂੰ ਜਾ ਕੇ ਇਹਦੀਆਂ ਟਿਕਟਾਂ ਪਹਿਲੀਆਂ ਬੁੱਕ ਕਰ ਲਈ ਅਤੇ ਜਦੋਂ ਬੁੱਕ ਕਰ ਲਈਏ ਤਾਂ ਮੈਨੂੰ ਨਾਲ ਦੀ ਨਾਲ ਫੋਨ ਕਰਦੀ ਤੇ ਜਾਂ ਫਿਰ ਮੈਨੂੰ ਮੈਸੇਜ ਡਰੋਪ ਮੈਸੇਜ ਡਰੋਪ ਕਰ ਦੀ ਤਾਂ ਕਿ ਮੈਨੂੰ ਪਤਾ ਲੱਗ ਜੇ ਵੀ ਟਿਕਟਾਂ ਬੁਕ ਕਰ ਤੀਆਂ ਅਤੇ ਉਸ ਤਰ੍ਹਾਂ ਨਾਲ ਇਹਦੇ ਖਾਣ ਪੀਣ ਦਾ ਹੋਰ ਸਮਾਨ ਅਵੇਲੇਵਲ ਕਰ ਲੀ ਅਤੇ ਥਈਏਟਰ ਪਲੇਅ ਤੋਂ ਬਾਅਦ ਫਿਰ ਆਪਾਂ ਉੱਥੇ ਜਿਹੜਾ ਪਾਰਕ ਹੈਗਾ ਮਹਾਰਾਜਾ ਪੈਲਸ ਉਹਦੇ ਵਿੱਚੋਂ ਪਾਰਕ ਵਿੱਚ ਆਪਾਂ ਘੁੰਮਾਂਗੇ ਉੱਥੇ ਬਹੁਤ ਕੁਛ ਦੇਖਣ ਵਾਲਾ ਜਗ੍ਹਾ ਹੈਗੀ ਅਤੇ ਉਹਦੇ ਵੀ ਨਾਲ ਇਨਜੋਏ ਕਰ ਲਵਾਂਗੇ ਅਤੇ ਹੋ ਸਕਦਾ ਤਾਂ ਮੇਰੇ ਨਾਲ ਇੱਕ ਫੈਮਲੀ ਵੀਚਾਰ ਸੀ ਵੀ ਆਪਾਂ ਫੈਮਲੀ ਨਾਲ ਹੀ ਇਨਜੋਏ ਕਰ ਲਈਏ ਫੈਮਲੀ ਅਤੇ ਬੱਚੇ ਜੇ ਦੋਨੇ ਆਪਣੇ ਨਾਲ ਸ਼ਾਮਿਲ ਹੋਣਗੇ ਤਾਂ ਉਹ ਵੀ ਆਪਣੇ ਇੰਜੋਏ ਦਾ ਇੱਕ ਪਾਰਟ ਬਣ ਜਾਣਗੇ ਉਹ ਵੀ ਇਹਦੇ ਵਿੱਚ ਸ਼ਾਮਿਲ ਹੋਣਗੇ ਤਾਂ ਬਸ ਤੂੰ ਇਹਦੀਆਂ ਪਲੇਅ ਦੀਆਂ ਟਿਕਟਾਂ ਦੇਖ ਕੇ ਆ ਅਤੇ ਜੇ ਮਿਲਦੀਆਂ ਹੋਈਆਂ ਅਤੇ ਨਾਲ ਦੀ ਨਾਲ ਬੁੱਕ ਕਰ ਦੀ ਅਤੇ ਮੈਨੂੰ ਨਾਲ ਹੀ ਇਨਫੋਮ ਕਰ ਦੀ ਮੈਨੂੰ ਵਟਸਐਪ 'ਤੇ ਵੀ ਕਰਦੀ ਟਿਕਟਾਂ ਤੁਸੀਂ ਉਹ ਕਰ ਲਈਆਂ ਜੇ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਨਾਲ ਦੀ ਨਾਲ ਤੁਸੀਂ ਦੱਸ ਦਿਓ ਵੀ ਆਹ ਪ੍ਰੋਬਲਮ ਆ ਰਹੀ ਆਗੀ ਅਤੇ ਜਰੂਰ ਬੁੱਕ ਕਰਨੀ ਆਪਾਂ ਇਹ ਥੀਏਟਰ ਪਲੇਅ ਵਿੱਚ ਜਾਣਾ ਗਾ ਅਤੇ ਦੇਖਣਾ ਹੈਗਾ ਇਹ ਛੁੱਟੀ ਨੂੰ ਆਪਾਂ ਖਾਲੀ ਨਹੀਂ ਛੱਡਣਾ ਇਹਦਾ ਪੂਰਾ ਪੂਰਾ ਫਾਇਦਾ ਚੱਕਣਾ ਹੈਗਾ ਓਕੇ ਭਰਾ ਠੀਕ ਆ ਜੀ ਓਕੇ ਓਕੇ ਡੀਅਰ ਬਾਏ